ਆਵਾਜਸ ਜਾਈ ਸਬੰਧਿਤ ਚੁਣੌਤੀਆਂ ਬਹੁਤ ਅੱਜ ਕੱਲ੍ਹ ਆ ਰਹੀਆਂ ਨੇ ਜਿਵੇਂ ਕਿ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਅੱਜ ਦੇ ਟ ਸਮੇਂ ਵਿੱਚ ਟਰੈਫਿਰ ਬਹੁਤ ਜ਼ਿਆਦਾ ਵੱਧ ਗਈ ਹੈ ਜਿਸ ਨਾਲ ਕਿ ਹਰ ਇੱਕ ਘਰ ਵਿੱਚ ਦੋ ਜਾਂ ਤਿੰਨ ਸਾਧਨ ਉਪਲਬਧ ਨੇ ਪਰ ਜੇ ਗੱਲ ਕਰੀਏ ਸੜਕਾਂ ਦੀ ਤਾਂ ਸੜਕਾਂ ਦੀ ਸਥਿਤੀ ਬਹੁਤ ਹੀ ਤਰਸਯੋਗ ਹੈ ਖ਼ਾਸ ਕਰਕੇ ਦੇਖਿਆ ਜਾਵੇ ਤਾਂ ਪਿੰਡਾਂ ਵਿੱਚ ਨਾ ਹੀ ਸੜਕਾਂ ਖੁੱਲ੍ਹੀਆਂ ਨੇ ਅਤੇ ਨਾਂ ਹੀ ਸੜਕਾਂ ਦੀ ਸਥਿਤੀ ਬਹੁਤ ਹੀ ਵਧੀਆ ਹੈ ਕਿ ਆਪਾਂ ਸਮੇਂ ਸਿਰ ਕਿਸੇ ਜਾ ਸਕੀਏ ਗੱਲ ਕਰ ਲਈਏ ਸ਼ਹਿਰਾਂ ਦੀ ਤਾਂ ਸ਼ਹਿਰਾਂ ਵਿੱਚ ਬਹੁਤ ਹੀ ਅੱਜ ਕੱਲ੍ਹ ਟਰੈਫਿਕ ਹੋ ਗਈ ਹੈ ਕਿ ਉਸ ਤੋਂ ਉੱਪਰ ਦੇਖਿਆ ਜਾਵੇਂ ਤਾਂ ਜਨਤਕ ਸਾਧਨ ਨੇ ਬਹੁਤ ਹੀ ਅੱਗੇ ਅੱਗੇ ਲੋਕ ਘੱਟ ਪਰੈਫਰ ਕਰ ਰਹੇ ਨੇ ਲੋਕ ਕੀ ਕਰਦੇ ਨੇ ਕਿ ਆਪਣਾ ਪਰਸਨਲ ਵਹੀਕਲ ਯੂਜ਼ ਕਰਦੇ ਨੇ ਕਿ ਜਿਸ ਨਾਲ ਕਿ ਟਰੈਫਿਕ ਦੀ ਸਮੱਸਿਆਂ ਤਾਂ ਆ ਹੀ ਰਹੀ ਹੈ ਅਤੇ ਨਾਲ ਨਾਲ ਕੀ ਹੈ ਕਿ ਆਪਣਾ ਅੱਜ ਕੱਲ੍ਹ ਬਹੁਤ ਹੀ ਦੁਰਘਟਨਾਵਾਂ ਵਾਪਰ ਰਹੀਆਂ ਨੇ ਤਾਂ ਸਾਨੂੰ ਅੱਜ ਕੱਲ੍ਹ ਦਦ ਸੋਚਣਾ ਚਾਹੀਦਾ ਇਸ ਬਾਰੇ ਕਿ ਆਪਾਂ ਟਰੈਫਿਕ ਨੂੰ ਘੱਟ ਕਰਕੇ ਜ਼ਿੰਦਗੀ ਨੂੰ ਥੋੜ੍ਹਾ ਸੁਖਾਲਾ ਬਣਾ ਸਕੀਏ